ਹਾਂਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਸਮਾਜਿਕ ਸੱਭਿਆਚਾਰ ਜਿਵੇਂ ਰੱਖੜੀ ਦਾ ਤਿਉਹਾਰ ਦਿਵਾਲੀ ਦਾ ਤਿਉਹਾਰ ਅਤੇ ਹੋਰ ਜਿਵੇਂ ਕਿ ਵਿਆਹਾਂ ਸ਼ਾਦੀਆਂ ਵਿੱਚ ਅਸੀਂ ਨਾਨਕ ਛੱਕਾਂ ਵਗੈਰਾ ਲਾਉਂਦੇ ਹਨ ਆਪਣੇ ਭਾਈਚਾਰੇ ਵਿੱਚ ਜਾਂਦੇ ਹਨ ਦੇਣ ਲੈਣ ਕਰਦੇ ਹਨ ਅਤੇ ਇੱਕ ਦੂਏ ਨੂੰ ਇੱਕ ਦੂਜੇ ਦੀ ਹੈਲਪ ਵੀ ਮਿਲਦੀ ਹੈ ਅਤੇ ਭਾਈਚਾਰੇ ਵਿੱਚ ਬਹੁਤ ਜਿਆਦਾ ਪੇਚਾਂ ਹਨ ਮੰਨੀ ਜਾਂਦੀ ਹੈ